ਸਾਡੇ ਪੰਜਾਬ ਵਿੱਚ ਸ਼ਿਲਪਕਾਰੀ ਖੇਤਰ ਦੇ ਵਿੱਚ ਦੇਖਿਆ ਜਾਏ ਕਿ ਇੱਥੋਂ ਜਦੋਂ ਬਾਹਰ ਸੈਲਾਨੀ ਆਉਂਦੇ ਹਨ ਜਾਂ ਬਾਹਰੋਂ ਕੋਈ ਟੂਰਿਸਟ ਆਉਂਦੇ ਹਨ ਉਹਨੂੰ ਦੇਖਦੇ ਹਨ ਇੱਥੇ ਜਿਹੜੇ ਮੰਦਰਾਂ ਦੇ ਵਿੱਚ ਫੋਟੋਆਂ ਮੂਰਤੀਆਂ ਲੱਗੀਆਂ ਹੁੰਦੀਆਂ ਹਨ ਉਹਨਾਂ ਨੂੰ ਦੇਖ ਕੇ ਬੜੇ ਹੀ ਖੁਸ਼ ਹੁੰਦੇ ਹਨ ਔਰ ਫੋਟੋਆਂ ਖਿੱਚਦੇ ਹਨ ਆਪਣੇ ਕੈਮਰਿਆਂ ਦੇ ਵਿੱਚ ਸਾਡੇ ਇੱਥੇ ਫੁਲਕਾਰੀ ਪੰਜਾਬੀ ਜੁੱਤੀ ਔਰ ਬੜੀ ਟਰਡੀਸ਼ਨਲ ਡਰੈੱਸਾਂ ਉਹ ਲੈ ਕੇ ਲੋਕ ਲੋਕ ਬੜੇ ਖੁਸ਼ ਹੁੰਦੇ ਹਨ ਔਰ ਉਹ ਸਾਡੇ ਇੱਥੇ ਕਈ ਜਿਸ ਤਰ੍ਹਾਂ ਕਈ ਵਾਰੀ ਝਾਕੀ ਨਿਕਲਦੀ ਹੁੰਦੀ ਉਹ ਦੇਖਦੇ ਹਨ ਬੜੇ ਖੁਸ਼ ਹੁੰਦੇ ਹਨ ਕਿ ਲੋਕ ਕਿਸ ਤਰ੍ਹਾਂ ਝਾਕੀ ਦੇ ਵਿੱਚ ਉਹਨਾਂ ਨੇ ਡਰੈੱਸਾਂ ਪਾਈਆਂ ਹੁੰਦੀਆਂ ਹੈ ਜਿਸ ਤਰ੍ਹਾਂ ਪ੍ਰਭਾਤ ਫੇਰੀ ਨਿਕਲਦੀ ਹੈ ਉਹਦੇ ਵਿੱਚ ਉਹ ਲੋਕ ਗੱਤਕਾ ਕਰਦੇ ਹਨ ਗੱਤਕਾ ਦੇਖਦੇ ਹਨ ਕਿਸ ਤਰ੍ਹਾਂ ਇਹ ਲੋਕ ਕਰ ਰਹੇ ਹੈ ਕਿਸ ਤਰ੍ਹਾਂ ਨਹੀਂ ਕਰ ਰਹੇ ਅਤੇ ਇੱਥੋਂ ਦਾ ਪਹਿਰਾਵਾ ਦੇਖ ਕੇ ਉਹ ਲੋਕ ਬੜੇ ਖੁਸ਼ ਹੁੰਦੇ ਅਕਸਰ ਦੇਖਿਆ ਜਾਂਦਾ ਹੈ ਕਿ ਬਾਹਰੋਂ ਜਿਹੜੇ ਫੋਰਨ ਤੋਂ ਜਿਹੜੇ ਸੈਲਾਨੀ ਆਉਂਦੇ ਹਨ ਉਹ ਇੱਥੋਂ ਦੀ ਸੂਟ ਸਲਵਾਰ ਨੂੰ ਬੜਾ ਫੋਲੋ ਕਰਦੇ ਹਨ ਔਰ ਇੱਥੋਂ ਦੀ ਪੰਜਾਬੀ ਜਨਾਨੀਆਂ ਸੂਟ ਸਲਵਾਰ ਪਾਉਂਦੇ ਹਨ ਅਤੇ ਪਾ ਕੇ ਆਪਣਾ ਫੋਟੋਆਂ ਖਿੱਚਵਾਉਂਦੇ ਹਨ ਅਤੇ